ਹੈਲੋ ਸਰ ਅਮਨ ਟਰੈਵਲਰਸ ਤੋਂ ਗੱਲ ਕਰਦੇ ਓਂ ਸਰ ਮੈਂ ਟੈਕਸੀ ਬੁੱਕ ਕਰਵਾਉਣੀ ਸੀ ਤੁਹਾਡੇ ਤੋਂ ਇੱਕ ਹਾਂਜੀ ਮੈਂ ਸਰ ਜਾਣਾ ਪਟਿਆਲਾ ਤੋਂ ਲੁਧਿਆਣਾ ਹਾਂਜੀ ਇਕੱਤੀ ਇਕੱਤੀ ਦਸੰਬਰ ਦੀ ਸ਼ਾਮ ਨੂੰ ਅਸੀਂ ਜਾ ਰਹੇ ਹਾਂ ਪਟਿਆਲਾ ਤੋਂ ਲੁਧਿਆਣਾ ਅਤੇ ਸਾਡੀਆਂ ਤਿੰਨ ਸਵਾਰੀਆਂ ਹੋਣਗੀਆਂ ਓਹਦੇ ਵਿੱਚ ਦੋ ਲੇਡੀਜ਼ ਹੋਣਗੇ ਅਤੇ ਇੱਕ ਜੈਂਟਸ ਅਤੇ ਸਾਨੂੰ ਕਾਰ ਦੀ ਉਪਲੱਬਧੀ ਦੱਸੋ ਵੀ ਇਕੱਤੀ ਦਸੰਬਰ ਦੀ ਸ਼ਾਮ ਤੱਕ ਇਹ ਮਿਲ ਜਾਏਗੀ ਤੁਹਾਡੇ ਕੋਲੋਂ ਸਾਡਾ ਕੌਂਟੈਕਟ ਨੰਬਰ ਤੁਸੀਂ ਨੋਟ ਕਰ ਲਉ ਏਟ ਵਨ ਫੋਰ ਸਿਕਸ ਟੂ ਥਰੀ ਵਨ ਟਰੀਪਲ ਸੈਵਨ ਇਸ ਨੰਬਰ 'ਤੇ ਕੋਲ ਕਰਕੇ ਸਰ ਸਾਨੂੰ ਦੱਸ ਦੇਣਾ ਤੁਸੀਂ